ਕਿਸੇ ਵਿਆਹ ਲਈ ਕੋਵਿਡ ਨਾਈਨਟੀਨ ਟੀਕਾਕਰਨ ਮੁਹਿੰਮ ਦਾ ਆਯੋਜਨ ਕਰਨਾ ਸਾਰੇ ਮਹਿਮਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਸੋਚਣਯੋਗ ਅਤੇ ਜ਼ਿੰਮੇਵਾਰ ਸੰਕੇਤ ਹੋ ਸਕਦਾ ਹੈ ਵੈਕਸੀਨ ਦੀ ਉਪਲਬਧਤਾ ਅਤੇ ਯੋਗਤਾ ਦੇ ਮਾਪਦੰਡਾਂ ਸਮੇਤ ਲੋਜਿਟਿਕਸ ਨੂੰ ਸਮਝ ਲਈ ਸਥਾਨਕ ਸਿਹਤ ਅਧਿਕਾਰੀਆਂ ਜਾਂ ਸਿਹਤ ਸੰਭਾਲ ਨਾਲ ਸਲਾਹ ਕਰਕੇ ਸ਼ੁਰੂਆਤ ਕਰੋ ਘਟਨਾ ਸਥਾਨ 'ਤੇ ਇੱਕ ਟੀਕਾਕਰਨ ਸਟੇਸ਼ਨ ਸਥਾਪਿਤ ਕਰਨ ਲਈ ਇਨ੍ਹਾਂ ਪੇਸ਼ੇਵਰਾਂ ਨਾਲ ਸਹਿਯੋਗ ਕਰੋ ਜਾਂ ਘਟਨਾ ਸਥਾਨ 'ਤੇ ਆਉਣ ਲਈ ਇੱਕ ਮੁਬਾਇਲ ਕਲੀਨਿਕ ਦਾ ਪ੍ਰਬੰਧ ਕਰੋ ਸਾਰੇ ਮਹਿਮਾਨਾਂ ਨੂੰ ਟੀਕਾਕਰਨ ਡਰਾਈਵ ਦੇ ਵੇਰਵਿਆਂ ਨੂੰ ਸਪੱਸ਼ਟ ਤੌਰ 'ਤੇ ਪਹਿਲਾਂ ਤੁਸੀਂ ਦੱਸ ਦਿਉ ਜਿਸ ਵਿੱਚ ਮਿਤੀ ਸਮਾਂ ਅਤੇ ਕੋਈ ਵੀ ਜ਼ਰੂਰੀ ਰਜਿਸਟਰੇਸ਼ਨ ਜਾਂ ਪਛਾਣ ਲੋੜਾਂ ਸ਼ਾਮਲ ਹਨ ਟੀਕਾਕਰਨ ਦੇ ਲਾਭਾਂ ਬਾਰੇ ਜਾਣਕਾਰੀ ਦਿਓ ਅਤੇ ਯਕੀਨ ਬਣਾ ਬਣਾਓ ਕਿ ਮਹਿਮਾਨ ਇੱਕ ਸੁਰੱਖਿਅਤ ਵਾਤਾਵਰਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਅਵੈਂਟ ਵਾਲੇ ਦਿਨ ਜਿਸ ਦਿਨ ਵਿਆਹ ਹੋਣਾ ਹੈ ਟੀਕਾਕਰਨ ਲਈ ਇੱਕ ਵਧੀਆ ਖੇਤਰ ਸੈੱਟ ਕਰੋ ਜਿਹੜੇ ਬੰਦੇ ਸਿੱਖੇ ਹੋਏ ਨੇ ਖਾਸ ਕਰਕੇ ਹੈਲਥ ਵਰਕਰ ਹੋਣ ਉਨ੍ਹਾਂ ਦਾ ਸਟਾਫ਼ ਇਹ ਯਕੀਨੀ ਬਣਾਉ ਕਿ ਸਾਰੀਆਂ ਲੋੜੀਂਦੀਆਂ ਡਾਕਟਰੀ ਸਪਲਾਈਆਂ ਸਹੂਲਤਾਂ ਡਾਕਟਰੀ ਉਪਕਰਨ ਉਨ੍ਹਾਂ ਦੇ ਕੋਲ ਮੌਜੂਦ ਹੋਣ ਸਹੂਲਤ ਲਈ ਪ੍ਰੀਵੈਂਟ ਰਜਿਸਟਰੇਸ਼ਨ ਜਾਂ ਵਾਕ ਇਨ ਵਿਕਲਪਾਂ ਦੇ ਨਾਲ ਸਹਾਇਤਾ ਦੀ ਪੇਸ਼ਕਸ਼ ਕਰੋ ਟੀਕਾਕਰਨ ਤੋਂ ਬਾਅਦ ਮਹਿਮਾਨਾਂ ਲਈ ਇੱਕ ਅਰਾਮਦਾਇਕ ਉਡੀਕ ਘਰ ਬਣਾਓ ਅਤੇ ਇਹ ਯਕੀਨੀ ਬਣਾਓ ਵੀ ਕਿਸੇ ਵੀ ਤਰ੍ਹਾਂ ਤਤਕਾਲ ਪ੍ਰਤੀਕਰਮ ਦੇ ਪ੍ਰਬੰਧਨ ਲਈ ਪ੍ਰੋਟੋਕੋਲ ਮੌਜੂਦ ਹੋਣ ਇਸ ਤੋਂ ਇਲਾਵਾ ਹਿੱਸਾ ਲੈਣ ਲ ਵਾਲਿਆਂ ਲਈ ਪ੍ਰਸ਼ੰਸਾ ਦੇ ਛੋਟੇ ਟੋਕਨਾਂ ਦੀ ਪੇਸ਼ਕਸ਼ ਕਰਨ ਬਾਰੇ ਵਿਚਾਰ ਕਰੋ ਅੰਤ ਵਿੱਚ ਹਰ ਕਿਸੇ ਦੀ ਸਿਹਤ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ ਵਿਆਹ ਦੇ ਤਿਉਹਾਰਾਂ ਦੇ ਹਿੱਸੇ ਵਜੋਂ ਟੀਕਾਕਰਨ ਮੁਹਿੰਮ ਨੂੰ ਸੁਰੱਖਿਅਤ ਉਤਸ਼ਾਹਿਤ ਕਰੋ ਅਤੇ ਘਟਨਾ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਲੋਜਿਸਟਿਕ ਜਾਂ ਮੈਡੀਕਲ ਸਵਾਲਾਂ ਨੂੰ ਸੰਭਾਲਣ ਲਈ ਤਿਆਰ ਰਹੋ